ਸਕੂਲ ਤੋਂ ਬਾਅਦ ਸ਼ਾਮ ਦੀ ਪ੍ਰਾਈਵੇਟ ਟਿਊਸ਼ਨ ਦੇ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ ਜਿਹੜਾ ਕੰਮ ਸਕੂਲ ਤੋਂ ਯਾਦ ਕਰਨ ਵਾਸਤੇ ਪੜ੍ਹਨ ਵਾਸਤੇ ਜਾਂ ਲਿਖਣ ਵਾਸਤੇ ਮਿਲਦਾ ਹੈ ਬੱਚਿਆਂ ਨੂੰ ਉਹ ਬੱਚੇ ਸ਼ਾਮ ਨੂੰ ਟਵੀਸ਼ਨ 'ਤੇ ਜਾ ਕੇ ਕਰ ਸਕਦੇ ਹਾਂ ਇਸ ਵਿਸ਼ਵ ਦੀ ਜੇਕਰ ਸਾਨੂੰ ਕਿਸੇ ਵਿਸ਼ੇ ਦੀ ਸਮਝ ਨਾ ਲੱਗੇ ਬੱਚਾ ਉਸ ਵਿਸ਼ੇ ਨੂੰ ਵਿਸਥਾਰ ਨਾਲ ਸਮਝਾ ਸਕਦੇ ਹਾਂ ਕਈ ਵਾਰ ਘਰ ਦੀਆਂ ਮਜ਼ਬੂਰੀਆਂ ਕਰਕੇ ਕਿਸੇ ਨੂੰ ਬਿਮਾਰੀ ਕਰਕੇ ਬੱਚਾ ਸਕੂਲ ਨਹੀਂ ਜਾ ਸਕਦਾ ਅਤੇ ਸਕੂਲ ਵਿੱਚ ਗੈਰ ਹਾਜ਼ਰ ਹੁੰਦਾ ਹੈ ਜਿਸ ਨਾਲ ਉਸ ਦੀ ਪੜ੍ਹਾਈ ਪਿੱਛੇ ਰਹਿ ਜਾਂਦੀ ਹੈ ਅਤੇ ਕਈ ਵਿਸ਼ਿਆਂ ਵਿੱਚ ਉਹ ਕਮਜ਼ੋਰ ਵੀ ਰਹਿ ਜਾਂਦਾ ਹੈ ਉਸ ਲਈ ਸ਼ਾਮ ਦੇ ਟਿਊਸ਼ਨ ਇੱਕ ਵਰਦਾਨ ਹੈ ਇਕ ਕਲਾਸ ਵਿੱਚ ਜਿਵੇਂ ਚਾਲੀ ਤੋਂ ਪੰਜਾਹ ਬੱਚੇ ਹੁੰਦੇ ਹਨ ਅਤੇ ਕੁਝ ਉਹਨਾਂ ਵਿੱਚ ਕਮਜ਼ੋਰ ਬੱਚੇ ਵੀ ਹੁੰਦੇ ਹਨ ਅਤੇ ਕੁਝ ਸ਼ਰਾਰਤੀ ਵੀ ਹੁੰਦੇ ਹਨ ਜਿਹੜੇ ਬੱਚੇ ਲਾਈਕ ਹੁੰਦੇ ਹਨ ਉਹ ਤਾਂ ਅਧਿਆਪਕ ਦੇ ਇੱਕ ਵਾਰੀ ਸਮਝਾਉਣ 'ਤੇ ਹੀ ਸਮਝ ਜਾਂਦੇ ਆ ਅਤੇ ਕੁਝ ਬ ਬੱਚੇ ਅਜਿਹੇ ਹੁੰਦੇ ਹਨ ਜਿੰਨ੍ਹਾਂ ਨੂੰ ਬਾਰ ਬਾਰ ਜਾਂ ਪਿਆਰ ਨਾਲ ਜਾਂ ਥੋੜ੍ਹਾ ਥੋੜ੍ਹਾ ਸਿਲੇਬਸ ਕਰਕੇ ਉਸ ਨੂੰ ਪੜ੍ਹਾਈ ਵਿੱਚ ਦਿਲਚਸਪੀ ਦਵਾ ਕੇ ਉਸ ਵਿਸ਼ੇ ਨੂੰ ਪੜ੍ਹਾਇਆ ਜਾਂਦਾ ਹੈ ਅਤੇ ਵਿਸਥਾਰ ਨਾਲ ਸਮਝਾਇਆ ਜਾਂਦਾ ਹੈ ਅਤੇ ਕਈ ਮਾਂ ਪਿਓ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦੇਣ ਕਰਕੇ ਉਹਨਾਂ ਨੂੰ ਟਿਊਸ਼ਨ 'ਤੇ ਪਾਉਂਦੇ ਹਨ ਤਾਂ ਜੋ ਉਹ ਟਿਵਿਸ਼ਨ 'ਤੇ ਜਾ ਕੇ ਆਪਣੀ ਪੜ੍ਹਾਈ ਪੂਰੀ ਕਰ ਸਕੇ ਅਤੇ ਬੱਚਿਆਂ ਦੇ ਬਰਾਬਰ ਆਪਣੇ ਆਪ ਪੜ੍ਹਾਈ ਵਿੱਚ ਵੀ ਨਿਪੁੰਨ ਹੋ ਸਕਣ ਅਜਿਹਾ ਕਰਨ ਨਾਲ ਉਹ ਆਪਣੇ ਪਾਠ ਜਿਹੜਾ ਸਲੇਬਸ ਹੋਵੇ ਉਸ ਨੂੰ ਵੀ ਚੰਗੀ ਤਰ੍ਹਾਂ ਕਰ ਸਕਦੇ ਹਨ ਅਤੇ ਇਸ ਤਰ੍ਹਾਂ ਉਹਨਾਂ ਵਿੱਚ ਆਤਮ ਵਿਸ਼ਵਾਸ ਵੀ ਵੱਧਦਾ ਹੈ ਅਤੇ ਜ਼ਿੰਦਗੀ ਵਿੱਚ ਕਮਜ਼ੋਰ ਬੱਚੇ ਵੱਡੇ ਹਾਸਲ ਹੋਕ ਮੁਕਾਮ ਹਾਸਿਲ ਕਰਦੇ ਹਨ ਅਤੇ ਕੁਝ ਪੜ੍ਹ ਕੇ ਸੀ ਏ ਆਈ ਸੀ ਅਫਸਰ ਵੀ ਬਣਦੇ ਹਨ ਪਰ ਇਹ ਸਭ ਕੁਝ ਚਾਪ ਸ਼ਾਮ ਦੀ ਟਵੀਸ਼ਨ ਕਰਕੇ ਹੀ ਹੋ ਸਕਦਾ ਹੈ ਕਿਉਂਕਿ ਉਹਨਾਂ ਨੂੰ ਐਕਸਟਰਾ ਟਿਊਸ਼ਨ ਪੜ੍ਹਨ ਨਾਲ ਉਹ ਆਪਣੀ ਪੜ੍ਹਾਈ ਚੰਗੀ ਤਰ੍ਹਾਂ ਕਰ ਸਕਦੇ ਹਨ ਅਤੇ ਆਪਣੀਆਂ ਕਮਜ਼ੋਰੀਆਂ ਨੂੰ ਵੀ ਦੂਰ ਕਰ ਸਕਦੇ ਹਨ ਜਦੋਂ ਮੈਂ ਟਿਊਸ਼ਨ ਲਗਾਈ ਸੀ ਮੈਨੂੰ ਮਾਸਟਰ ਜੀ ਨੇ ਸਟੈਂਨਸ ਸਿਖਾਏ ਸਨ ਜੋ ਅੱਜ ਤੱਕ ਵੀ ਮੈਨੂੰ ਪੂਰੀ ਤਰ੍ਹਾਂ ਯਾਦ ਹਨ ਕਿਉਂਕਿ ਮੈਂ ਉਸ ਸਟੈਂਨਸ ਨੂੰ ਜਦੋਂ ਉਹ ਸਮਝਾ ਰਹੇ ਸਨ ਦਿਲ ਲਗਾ ਕੇ ਕੀਤਾ ਸੀ ਅਤੇ ਉਹਨਾਂ ਦੀ ਇੱਕ ਇੱਕ ਅੱਖਰ ਨੂੰ ਆਪਣੇ ਦਿਮਾਗ ਵਿੱਚ ਪਾਇਆ ਸੀ ਜਿਸ ਨਾਲ ਕਿ ਮੈਂ ਅੱਜ ਮਹਾਂ ਇਸ ਮੁਕਾਮ 'ਤੇ ਪਹੁੰਚਿਆ ਹਨ ਅਤੇ ਸੀ ਏ ਬਣ ਗਏ ਹਨ ਇਸ ਦਾ ਸਭ ਤੋਂ ਵੱਡਾ ਸ਼ੇਅਰ ਮੇਰੇ ਅਧਿਆਪਕ ਅਤੇ ਮੇਰੇ ਮਾਂ ਪਿਓ ਨੂੰ ਜਾਂਦਾ ਹੈ ਜਿਨ੍ਹਾਂ ਦੀ ਬਦੌਲਤ ਸ਼ਾਮ ਦੀ ਟਿਊਸ਼ਨ ਪੜ੍ਹ ਕੇ ਅੱਜ ਮੈਂ ਆਪਣੀ ਜ਼ਿੰਦਗੀ ਦੇ ਕੁਝ ਮੁਕਾਮ ਹਾਸਿਲ ਕੀਤੇ ਹਨ